ਪੰਜਾਬ ਵਿੱਚ ਵਪਾਰਕ ਖੇਤਰ ਸਥਾਨ ਭਾਈਚਾਰੇ ਨਾਲ ਮਤਲਬ ਕਿ ਬਹੁਤ ਜ਼ਿਆਦਾ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ ਜਿਵੇਂ ਕਿ ਪੰਜਾਬ ਵਿੱਚ ਕੋਈ ਵੀ ਵਪਾਰਕ ਅਦਾਰਾ ਹੈ ਵਪਾਰਕ ਖੇਤਰ ਹੈ ਜਾਂ ਫਿਰ ਕੋਈ ਸੰਸਥਾ ਹੈ ਉਹਨਾਂ ਵਿੱਚ ਕੰਮ ਕਰਨ ਦੇ ਲਈ ਸਭ ਤੋਂ ਜਿਹੜੀ ਪਹਿਲੀ ਪਹਿਲ ਹੈ ਉਹ ਕਿਹਾ ਹੈ ਮਤਲਬ ਉੱਥੋਂ ਦੇ ਜਿਹੜੇ ਸਥਾਨਕ ਲੋਕ ਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੇਕਰ ਕੋਈ ਜਿਹੜੀ ਵਪਾਰਕ ਸੰਸਥਾ ਹੈ ਉਹ ਵਪਾਰਕ ਸੰਸਥਾ ਕਿਸੇ ਜਾਤ ਨਾਲ ਰਿਲੇਟਿਡ ਹੈ ਜਾਤ ਦੇ ਨਾਲ ਜੁੜੀ ਹੋਈ ਹੈ ਮਤਲਬ ਜਿਸ ਬੰਦੇ ਨੇ ਉਹ ਜਿਹੜੀ ਵਪਾਰਕ ਸੰਸਥਾ ਹੈ ਉਹ ਸ਼ੁਰੂ ਕੀਤੀ ਹੈ ਉਹ ਜਿਹੜੀ ਵਪਾਰਕ ਸੰਸਥਾ ਜਿਸ ਜਾਤ ਦੇ ਬੰਦੇ ਨੇ ਸ਼ੁਰੂ ਕੀਤੀ ਹੈ ਤਾਂ ਫਿਰ ਉਹ ਬੰਦਾ ਹੈ ਜਿਹੜਾ ਉਹ ਆਪਣੀ ਜਾਤ ਦੇ ਨਾਲ ਰਿਲੇਟਡ ਕਰਦੇ ਜਿਹੜੇ ਬੰਦੇ ਆ ਉਹਨਾਂ ਨੂੰ ਹੀ ਕੰਮ ਦੇ ਉੱਤੇ ਰੱਖਦਾ ਹੈ ਇਸ ਤਰ੍ਹਾਂ ਕਿਆ ਹੈ ਜੋ ਵਪਾਰਕ ਖੇਤਰ ਹੈ ਇਹ ਜਿਹੜੇ ਸਥਾਨਕ ਭਾਈਚਾਰਾ ਮਤਲਬ ਜਿਹੜਾ ਉਹਦਾ ਭਾਈਚਾਰਾ ਹੁੰਦਾ ਉਸ ਸਥਾਨਕ ਤੌਰ 'ਤੇ ਜੁੜਿਆ ਹੋਇਆ ਭਾਈਚਾਰਾ ਹੁੰਦਾ ਹੈ ਉਹਨਾਂ ਨੂੰ ਉਸ ਵਪਾਰਕ ਖੇਤਰ ਦੇ ਵਿੱਚ ਕੰਮ ਕਰਨ ਦੀ ਸਭ ਤੋਂ ਪਹਿਲੀ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਵਪਾਰਕ ਖੇਤਰ ਹੈ ਜੋ ਮਤਲਬ ਇਹਦਾ ਵੱਡਾ ਕੰਮ ਇਹੀ ਹੈ ਕਿ ਉਹ ਉਹਨਾਂ ਨੂੰ ਕੰਮ ਦੇ ਕੇ ਨੇੜੇ ਦੇ ਲੋਕਾਂ ਨੂੰ ਕੰਮ ਦੇ ਕੇ ਅਤੇ ਉਹ ਜਿਹੜੀ ਉੱਥੇ ਦੀ ਬੇਰੁਜ਼ਗਾਰੀ ਹੈ ਬੇਰੁਜ਼ਗਾਰੀ ਨੂੰ ਘੱਟ ਕੀਤਾ ਜਾਂਦਾ ਹੈ ਬੇਰੁਜ਼ਗਾਰੀ ਨੂੰ ਘੱਟ ਕੀਤਾ ਜਾਂਦਾ ਹੈ ਇਹ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਥੋੜ੍ਹੀ ਜ਼ਿਆਦਾ ਨਹੀਂ ਪਰੰਤੂ ਥੋੜ੍ਹੀ ਬਹੁਤ ਘਟੀ ਹੈ ਉਦਾਹਰਨ ਦੇ ਤੌਰ 'ਤੇ ਜਿਵੇਂ ਕਿ ਇਹ ਪੰਜਾਬ ਦੇ ਨਾਲ ਲੱਗਦੇ ਜਿਹੜੇ ਕਿ ਡਿਸਟ੍ਰਿਕਟ ਹਨ ਜਿਵੇਂ ਕਿ ਪੰਜਾਬ ਦੇ ਡਿਸਟ੍ਰਿਕਟ ਜਿਵੇਂ ਕਿ ਰੋਪੜ ਹੋ ਗਿਆ ਮੋਹਾਲੀ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਹਨਾਂ ਦੇ ਨਾਲ ਜਿਹੜੇ ਹਿਮਾਚਲ ਦਾ ਮਤਲਬ ਜੋ ਹੈ ਜ ਸਥਾਨ ਲੱਗਦੇ ਹਨ ਜਿਵੇਂ ਕਿ ਇਹ ਉਨਾ ਹੋ ਗਿਆ ਬੱਦੀ ਹੋ ਗਿਆ ਨਾਲਾਗੜ ਹੋ ਗਿਆ ਇਹਨਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਹਨ ਇਹਨਾਂ ਵਿੱਚ ਜਿਹੜੀਆਂ ਕੰਪਨੀਆਂ ਹਨ ਇਹ ਕੰਪਨੀਆਂ ਦੇ ਵਿੱਚ ਜਿਹੜੇ ਜ਼ਿਆਦਾਤਰ ਜਿਹੜੇ ਕੰਮ ਕਰਨ ਵਾਲੇ ਵਿਅਕਤੀ ਹਨ ਉਹ ਪੰਜਾਬ ਦੇ ਇਹਨਾਂ ਖੇਤਰ ਤੋਂ ਜਾਂਦੇ ਹਨ ਜਿੱਦਾਂ ਕਿ ਰੋਪੜ ਦੇ ਲੋਕ ਬੱਦੀ ਜਾ ਕੇ ਕੰਮ ਕਰਦੇ ਹਨ ਰੋਪੜ ਦੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਮਤਲਬ ਨੇੜੇ ਤੇੜੇ ਦੇ ਲੋਕ ਆ ਜਿਹੜਿਆਂ ਦੀ ਬਾਉਂਡਰੀ ਹਿਮਾਚਲ ਦੇ ਨਾਲ ਲੱਗਦੀ ਹੈ ਮਤਲਬ ਬੱਦੀ ਨਾਲਾਗੜ ਦੇ ਨਾਲ ਲੱਗਦੀ ਹੈ ਉਹ ਲੋਕ ਉੱਥੇ ਜਾ ਕੇ ਕੰਮ ਕਰਦੇ ਨੇ ਇਵੇਂ ਅਸੀਂ ਕਹਿ ਸਕਦੇ ਹਾਂ ਕਿ ਜੋ ਵਪਾਰਕ ਖੇਤਰ ਹੈ ਉਹ ਸਥਾਨਕ ਭਾਈਚਾਰੇ ਦੇ ਲਈ ਬਹੁਤ ਜ਼ਿਆਦਾ ਮਤਲਬ ਜੁੜਿਆ ਹੋਇਆ ਹੈ ਅਤੇ ਉਹ ਕਿਆ ਹੈ ਉਹ ਸੇਵਾ ਮਤਲਬ ਪ੍ਰਧਾਨ ਵੀ ਕਰਦਾ ਹੈ ਅਤੇ ਉਹਨਾਂ ਨੂੰ ਕੰਮ ਕਰਨ ਦੇ ਮੌਕੇ ਵੀ ਦਿੰਦਾ ਹੈ ਉਹਨਾਂ ਨੂੰ ਤਨਖਾਹਾਂ ਵੀ ਦਿੰਦਾ ਹੈ ਜਿਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਮਤਲਬ ਰੋਜ਼ ਦਾ ਦਿਨਚਰਿਆ ਦਾ ਜਿਹੜਾ ਸਮਾਨ ਹੁੰਦਾ ਦਿਨਚਰਿਆ ਮਤਲਬ ਜੋ ਵੀ ਉਹਨਾਂ ਦੀ ਲੋੜਾਂ ਹੁੰਦੀਆਂ ਉਹਨਾਂ ਦੀ ਪੂਰਤੀ ਹੋ ਪਾਉਂਦੀ ਹੈ ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਹੜੀ ਵਪਾਰਕ ਖੇਤਰ ਹੈ ਉਹ ਸਥਾਨਕ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ ਤੇ ਇਹ ਉਹਨਾਂ ਨੂੰ ਬੇਰੁਜ਼ਗਾਰੀ ਤੋਂ ਦੂਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ